ਹੈਲੋ ਸਰ ਸਰ ਐਕਚੁਲੀ ਮੈਂ ਕਿਤੇ ਜਾਣਾ ਸੀ ਅਤੇ ਮੈਂ ਇੱਕ ਕੈਬ ਬੁੱਕ ਕਰਨੀ ਸੀ ਪਰ ਇਸ ਸਥਾਨਕ ਇਸ ਲੋਕਲ ਏਰੀਆ ਨੂੰ ਸਥਾਨਕ ਏਰੀਏ ਨੂੰ ਮੈਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਇਸ ਕਰਕੇ ਮੈਂ ਤੁਹਾਡੀ ਮਦਦ ਚਾਹੁੰਦੀ ਹਾਂ ਅਤੇ ਅਗਰ ਮੈਂ ਕੈਬ ਬੁੱਕ ਕਰਨੀ ਹੈ ਤਾਂ ਮੈਂ ਜਾਣਾ ਤਾਂ ਕਿਤੇ ਲੋਕਲ ਹੀ ਹੈ ਠੀਕ ਹੈ ਨਜ਼ਦੀਕ ਹੀ ਹੈ ਅਤੇ ਲੇਕਿਨ ਮੈਨੂੰ ਜ਼ਿਆਦਾ ਡਰਾਈਵਰ ਦਾ ਕੀ ਖਰਚਾ ਪਾਣੀ ਹੈ ਕਿਸ ਤਰ੍ਹਾਂ ਦਾ ਵਿਵਹਾਰ ਹੈ ਅਤੇ ਇਸ ਬਾਰੇ ਵੀ ਮੈਂ ਕੁਛ ਜਾਨਣਾ ਚਾਹੁੰਦੀ ਹਾਂ ਅਤੇ ਮੀਨਸ ਮੇਰਾ ਹਰ ਇੱਕ ਮੀਨਸ ਫੀਡਬੈਕ ਕਿਸ ਤਰ੍ਹਾਂ ਉਹਨਾਂ ਦਾ ਜਾਣਾ ਕਿਸ ਤਰ੍ਹਾਂ ਮੀਨਸ ਬੁੱਕ ਕਰੀਏ ਕਿਸ ਤਰ੍ਹਾਂ ਉਹ ਘਰ ਤੱਕ ਪਹੁੰਚਣਗੇ ਅਤੇ ਕਿੰਨੇ ਮੀਨਸ ਚਾਰਜਿਜ ਉਹਨਾਂ ਨੂੰ ਐਕਸ ਦੇਣੇ ਪੈਂਦੇ ਆ ਪਹਿਲੇ ਕਿੰਨੇ ਦੇਣੇ ਪੈਂਦੇ ਆ ਅਤੇ ਫਿਰ ਬਾਅਦ 'ਚੋਂ ਵਾਪਿਸ ਆਉਣ 'ਤੇ ਕੁਝ ਜਮ੍ਹਾਂ ਕਰਵਾਉਣਾ ਜਾਂ ਫਿਰ ਸਟਾਰਟਿੰਗ 'ਤੇ ਸਾਰਾ ਕੁਛ ਸਾਰੇ ਪੈਸੇ ਦੇਣੇ ਪੈਂਦੇ ਆ ਅਤੇ ਕੀ ਮਤਲਬ ਕਿ ਕਿਸ ਜਗ੍ਹਾ ਤੋਂ ਕੈਬ ਹੋਣੀ ਆ ਅਤੇ ਕਿੱਥੋਂ ਹੋਣੀ ਆ ਅਤੇ ਕਿਸ ਤਰ੍ਹਾਂ ਕਰਨੀ ਆ ਇਹਦੀ ਮੈਨੂੰ ਸਾਰੀ ਨੌਲੇਜ ਮਤਲਬ ਕਿ ਜਾਣਕਾਰੀ ਚਾਹੀਦੀ ਆ ਅਤੇ ਹੋਰ ਵੀ ਮੀਨਸ ਰਸਤੇ ਵਗੈਰਾ ਦੀ ਜਾਣਕਾਰੀ ਵੀ ਲੋਕੇਸ਼ਨ ਵਗੈਰਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਭੇਜਣੀ ਆ ਆਪਣਾ ਐਡਰੈੱਸ ਵਗੈਰਾ ਕਿਸ ਤਰ੍ਹਾਂ ਭੇਜਣਾ ਵਾ ਜਾਂ ਫਿਰ ਉਹ ਕਿੱਥੇ ਪਰਮਾਨੈਂਟ ਸਾਨੂੰ ਪੱਕੀ ਜਾਣਕਾਰੀ ਉਹਨਾਂ ਬਾਰੇ ਮਿਲ ਸਕਦੀ ਆ ਅਤੇ ਅਸੀਂ ਉਹਨਾਂ ਨੂੰ ਕਿੱਥੇ ਜਾ ਕੇ ਸੰਪਰਕ ਕਰੀਏ ਕਿ ਅਸੀਂ ਉਹਨਾਂ ਦੀ ਕੈਬ ਬੁੱਕ ਕਰਨੀ ਆ ਅਤੇ ਉਹਨਾਂ ਨੂੰ ਜਿਸ ਜਗ੍ਹਾ 'ਤੇ ਅਸੀਂ ਜਾਣਾ ਵਾ ਲੋਕੇਸ਼ਨ ਭੇਜਣੀ ਪਵੇਗੀ ਜਾਂ ਫਿਰ ਉਹਨਾਂ ਨੂੰ ਉਸ ਦੀ ਜਾਣਕਾਰੀ ਹੋਵੇਗੀ ਜਾਂ ਕਿਸ ਤਰ੍ਹਾਂ ਦੱਸਣਾ ਪਵੇਗਾ ਅਤੇ ਇਹ ਸਾਰੀ ਜਾਣਕਾਰੀ ਮੈਂ ਚਾਹੁੰਦੀ ਹਾਂ ਅਤੇ ਤੁਹਾਡੇ ਅੱਗੇ ਰਿਕੁਐਸਟ ਆ ਕਿ ਤੁਸੀਂ ਜਾਣਕਾਰੀ ਮੈਨੂੰ ਦਿਓ ਅਤੇ ਮੈਨੂੰ ਡਰਾਈਵਰ ਦਾ ਸਾਰਾ ਸਾਰੀ ਜਾਣਕਾਰੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਮਤਲਬ ਕਿ ਅਸੀਂ ਉਹਨਾਂ ਦੀ ਕੈਬ ਨੂੰ ਬੁੱਕ ਕਰ ਸਕਦੇ ਅ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਅਮਾਊਂਟ ਦੇਣਾ ਹੈ